ਹਾਂਜੀ ਸੌ ਆਈ ਥਿੰਕ ਅਗਰ ਮੈਨੂੰ ਔਪਰਚਿਊਨਿਟੀ ਮਿਲਦੀ ਹੈ ਤਾਂ ਮੈਂ ਕੈਨੇਡਾ ਚੂਜ਼ ਕਰਾਂਗਾ ਬੀਕੌਜ਼ ਆਈ ਥਿੰਕ ਕਨੇਡਾ ਹੁਣ ਜਿਹੜੀ ਮਲਟੀ ਸੁਸਾਇਟੀ ਬਣ ਗਈ ਹੈ ਮਲਟੀ ਕਲਚਰ ਸੁਸਾਇਟੀ ਬਣ ਗਈ ਹੈ ਅਤੇ ਕਾਫੀ ਤਰ੍ਹਾਂ ਦੇ ਜਿਹੜੇ ਲੋਕ ਉੱਥੇ ਰਹਿ ਰਹੇ ਹੈ ਜਿਹੜੇ ਅਲੱਗ ਅਲੱਗ ਦੇਸ਼ਾ ਤੋਂ ਆਏ ਹੈ ਅਤੇ ਵੈਦਰ ਦੇ ਕਾਫੀ ਕੋਲਡ ਵੈਦਰ ਹੈ ਇਫ਼ ਆਈ ਅਗਰ ਮੈਂ ਆਪਣੀ ਕੰਪੇਅਰ ਕਰਾਂ ਕੰਟਰੀ ਨਾਲ ਇੱਥੇ ਕਾਫੀ ਗਰਮੀ ਹੈ ਤੋਂ ਸੌ ਥੋੜਾ ਮੈਨੂੰ ਥੋੜਾ ਰਿਲੈਕਸੇਸ਼ਨ ਵੀ ਮਿਲੇਗਾ ਔਰ ਕਾਫੀ ਟੂਰਿਸਟ ਪਲੇਸਿਸ ਅੱਛੀ ਹੈ ਉੱਥੇ ਜਿਹੜੀ ਮੈਂ ਦੇਖਣਾ ਚਾਵਾਂਗਾ ਜਿੱਦਾਂ ਕਿ ਨਾਇਗਰਾ ਫੋਲ ਹੋ ਗਿਆ ਏ ਜਿਹੜਾ ਬੋਡਰ 'ਤੇ ਹੈ ਯੂ ਐੱਸ ਏ ਕੈਨੇਡਾ 'ਤੇ ਕਾਫੀ ਫੇਮਸ ਹੈ ਅਤੇ ਕਾ ਕਾਫੀ ਲੋਕ ਜਾਂਦੇ ਹੈ ਜਿਹੜੇ ਹਨੀਮੂਨ ਜਿਹੜੇ ਕਪਲਸ ਹੈ ਉੱਥੇ ਹੀ ਸਭ ਤੋਂ ਪਹਿਲਾਂ ਉੱਥੇ ਹੀ ਜਾਂਦੇ ਆ ਦੇਖਣ ਲਈ ਅਤੇ ਹੋਰ ਕਾਫੀ ਸੀਟੀਆਂ ਹੈ ਜਿੱਦ ਟਰਾਂਟੋ ਟਰਾਂਟੋ ਨੂੰ ਮਿੰਨੀ ਪੰਜਾਬ ਕਹਿੰਦੇ ਹੈ ਅਤੇ ਮੇਰਾ ਇੱਕ ਵਾਰ ਕਿਉਂਕਿ ਪੰਜਾਬੀ ਦੀ ਪਾਪੂਲੇਸ਼ਨ ਜ਼ਿਆਦਾ ਉੱਥੇ ਹੈ ਅਤੇ ਮੈਂ ਵਿਜ਼ਿਟ ਕਰਾਂਗਾ ਉੱਥੇ ਜਾਵਾਂਗਾ ਅਤੇ ਹੋਰ ਕਾਫੀ ਐਡਵੈਂਚਰ ਸਪੋਰਟਸ ਹੈ ਜਿਹੜੇ ਮੈਂ ਪਸੰਦ ਕਰਾਂਗਾ ਉੱਥੇ ਜਿੱਦਾਂ ਕਿ ਸਕਿੰਗ ਹੈ ਸਕਿੰਗ ਜਿਹੜੀ ਕਿ ਮੇਰੀ ਫੇਵਰੇਟ ਗੇਮ ਹੈ ਉਸ ਤੋਂ ਬ ਬਾਅਦ ਕਾਫੀ ਸ਼ੋਪਿੰਗ ਮੋਲ ਹੈ ਜਿਹੜੇ ਕਾਫੀ ਫੇਮਸ ਹੈ ਸੌ ਆਈ ਥਿੰਕ ਕਾਫੀ ਅੱਛਾ ਐਕਸਪੀਰੀਐਂਸ ਹੋਵੇਗਾ ਮੇਰੇ ਲਈ ਇੱਕ ਇੱਕ ਯਾਤਰਾ ਕਰਨਾ